ਇੱਕ ਦਿਨ ਰਾਤ ਨੂੰ ਪੌਣੇ ਇੱਕ ਵਜੇ ਮੈਨੂੰ ਕਾੱਲ ਆਈ ਕਿ ਝੂੰਗੀਆਂ ਰੋਡ 'ਤੇ ਸਥਿਤ ਜਗਤਾਰ ਡੇਅਰੀ 'ਤੇ ਅੱਗ ਲੱਗੀ ਹੋਈ ਹੈ ਅਤੇ ਅਸੀਂ ਬਹੁਤ ਹੀ ਜਲਦੀ ਕਰਕੇ ਪੰਜ ਮਿੰਟ ਦੇ ਪੰਜ ਸੱਤ ਮਿੰਟ ਦੇ ਅੰਦਰ ਅੰਦਰ ਉੱਥੇ ਅੱਗ ਬੁਝਾਉਣ ਲਈ ਪਹੁੰਚ ਗਏ ਅਤੇ ਅਸੀਂ ਦੇਖਿਆ ਕਿ ਉਥੇ ਸਥਿਤੀ ਬਹੁਤ ਜ਼ਿਆਦਾ ਵਿਗੜੀ ਹੋਈ ਸੀ ਪੂਰਾ ਸ਼ੋਅਰੂਮ ਧੂੰਏ ਦੇ ਨਾਲ ਭਰਿਆ ਹੋਇਆ ਸੀ ਅਤੇ ਅਸੀਂ ਪਾਣੀ ਦੀਆਂ ਪਾਈਪਾਂ ਲਗਾ ਕੇ ਦੋ ਤਿੰਨ ਮਿੰਟ ਵਿੱਚ ਹੀ ਉਸ ਅੱਗ 'ਤੇ ਕੰਟਰੋਲ ਪਾ ਲਿਆ